ਵਧੀਆ ਪੋਰਟਰੇਟ ਵਿੱਚ ਵਿਅਕਤੀ ਦੀ ਸ਼ਖਸੀਅਤ ਪਛਾਣ ਅਤੇ ਇੱਕ ਅੰਦਰੂਨੀ ਕਹਾਣੀ ਚਮਕਦੀ ਹੈ ਇੱਕ ਵਧੀਆ ਪੋਰਟਰੇਟ ਬਣਾਉਣ ਵਿੱਚ ਮੁੱਖ ਤੱਤ ਸਥਾਨ ਰੌਸ਼ਨੀ ਰਚਨਾ ਭਾਵਨਾ ਪਿਛੋਕੜ ਪ੍ਰੋਪਸ ਸੰਪਾਦਨ ਤਕਨੀਕੀ ਸੈਟਿੰਗ ਆਦਿ ਸਹਾਇਤਾ ਕਰਦੇ ਹਨ ਜਿੱਥੋਂ ਤੱਕ ਇੱਕ ਵਧੀਆ ਪੋਟਰੇਟ ਬਣਾਉਣ ਦੀ ਸਲਾਹ ਦੀ ਗੱਲ ਹੈ ਮੈਂ ਕਹਾਂਗੀ ਕਿ ਅੱਖਾਂ 'ਤੇ ਧਿਆਨ ਕੇਂਦਰਿਤ ਕਰੋ ਕਿਉਂਕਿ ਇੱਕ ਪੋਰਟਰੇਟ ਵਿੱਚ ਅੱਖਾਂ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੁੰਦਾ ਜਿਵੇਂ ਕਿ ਕਹਾਵਤ ਹੈ ਅੱਖਾਂ ਆਤਮਾ ਦੀ ਖਿੜਕੀ ਹਨ ਅਤੇ ਇੱਕ ਪੋਰਟਰੇਟ ਵਿੱਚ ਇਹ ਅੱਖਾਂ ਹਨ ਜੋ ਚਿੱਤਰ ਦੇ ਕਿਸੇ ਵੀ ਹੋਰ ਹਿੱਸੇ ਨਾਲੋਂ ਵੱਧ ਸਾਨੂੰ ਵਿਅਕਤੀ ਨਾਲ ਜੁੜਿਆ ਹੋਇਆ ਮਹਿਸੂਸ ਕਰਾਉਂਦੀਆਂ ਹਨ ਮੋਹਿਤ ਕਰਦੀਆਂ ਹਨ ਅਤੇ ਮਹਿਸੂਸ ਕਰਾਉਂਦੀਆਂ ਹਨ ਉਹਨਾਂ ਨੂੰ ਦਰਸ਼ਕ ਨਾਲ ਸੰਚਾਰ ਕਰਨ ਦਿਓ